ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਅਭਿਸ਼ੇਕ ਗੱਲ ਕਰ ਰਿਹਾ ਜੀ ਚਾਵਲਾ ਫਰੂਟ ਵੈਜੀਟੇਬਲ ਤੋਂ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਉਹ ਮੈਂ ਮੈਨੂੰ ਨਾ ਤੁਹਾਡਾ ਨੰਬਰ ਦਿੱਤਾ ਸੀ ਪ੍ਰਿੰਸ ਨੇ ਤਾਂ ਆਪਾਂ ਅਜੇ ਮਾਨਸਾ 'ਚ ਨਵੇਂ ਸ਼ਿਫਟ ਹੋਏ ਹਾਂ ਤਾਂ ਸਾਨੂੰ ਨਵੇਂ ਘਰ ਦੇ ਮਹੂਰਤ ਵਾਸਤੇ ਨਾ ਸਬਜ਼ੀਆਂ ਦੀ ਲੋੜ ਪੈ ਗਈ ਔਰਗੈਨਿਕ ਸਬਜ਼ੀ ਚਾਹੀਦੀਆਂ ਸੀ ਸਾਨੂੰ

ਹਾਂ ਸਾਡੇ ਕੋਲ ਹੈਗਾ ਨਹੀਂ ਕੋਈ ਵੀਹਕਲ ਇੱਦਾਂ ਕਰਿਓ ਤੁਸੀਂ ਤੁਸੀਂ ਪਹੁੰਚਾ ਦਿਓ ਤਾਂ ਫਿਰ ਭਾਅ ਕੀ ਹੈਗਾ ਪੰਜਾਹ ਸੱਠ ਆਹੋ ਅਸੀਂ ਸੋਚ ਰਹੇ ਹਾਂ ਅਸੀਂ ਮਿਕਸ ਵੈਜ ਦਾ ਸੋਚ ਰਹੇ ਹਾਂ ਜੀ ਮਿਕਸ ਵੈਜ ਤਾਂ ਇੱਕ ਦੂਜੀ ਪਨੀਰ ਵਾਲੀ ਕਰ ਦਿਓ ਭਾਅ ਜੀ ਤੁਸੀਂ ਡਿਲੀਵਰੀ ਕਰ ਦਿਓ ਪਰ ਪਹਿਲਾਂ ਮੈਨੂੰ ਭਾਅ ਤਾਂ ਦੱਸ ਦਿਓ ਮੈਂ ਤੁਹਾਨੂੰ ਸਬਜ਼ੀਆਂ ਲਿਖਾਉਂਦਾ ਤੁਸੀਂ ਸਾਡੇ ਘਰ ਪੁਜਵਾ ਦਿਓ ਸ਼ਿਮਲਾ ਮਿਰਚ ਦਸ ਕਿੱਲੋ ਕਰ ਦਿਓ

ਅਤੇ ਸੱਤ ਕਿੱਲੋ ਫ਼ਲੀ ਕਰ ਦਿਓ ਫ਼ਲੀਆਂ ਫ਼ਲੀਆਂ ਦਸ ਕਿੱਲੋ ਆਲੂ ਅਤੇ ਪੰਦਰ੍ਹਾਂ ਕਿੱਲੋ ਪਿਆਜ ਅਤੇ ਪੰਦਰ੍ਹਾਂ ਕਿੱਲੋ ਟਮਾਟਰ ਤਾਂ ਇੱਕ ਕੱਟਾ ਹੀ ਭੇਜ ਦਿਓ ਫਿਰ ਹਾਂਜੀ ਹਾਂਜੀ ਪਨੀਰ ਹਾਂਜੀ ਹਾਂਜੀ ਦਸ ਕਿੱਲੋ ਬਹੁਤ ਹੋਵੇਗਾ ਤੁਸੀਂ ਐਡਰੈਸ ਨੋਟ ਕਰਿਓ ਖਸਰਾ ਨੰਬਰ ਤਿੰਨ ਸੌ ਚੌਂਹਠ ਮੁਹੱਲਾ ਬੀਬੀ ਆਲਾ ਮਾਨਸਾ ਹਾਂਜੀ ਹਾਂਜੀ ਅਸੀਂ ਨਵਾਂ ਹੀ ਸ਼ਿਫਟ ਕੀਤਾ ਏ ਜੀ ਕਦੋਂ ਕਦੋਂ ਤਾਈ ਪਹੁੰਚਾ ਦੋਗੇ ਚੰਗਾ ਚੰਗਾ ਭਾਅ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ